ਸਤਿ ਸ਼੍ਰੀ ਅਕਾਲ ਮੇਰਾ ਨਾਮ ਜਪਨੀਤ ਕੌਰ ਹੈ ਕੀ ਤੁਸੀਂ ਅਨਮੋਲ ਰੈਸਟੋਰੈਂਟ ਤੋਂ ਗੱਲ ਕਰ ਰਹੇ ਹੋ ਸਰ ਡਿਨਰ ਲਈ ਕੁਛ ਖਾਣ ਦੀ ਸਮੱਗਰੀ ਦਾ ਔਡਰ ਦੇਣਾ ਸੀ ਮੇਰੇ ਘਰ ਕੁਛ ਮਹਿਮਾਨ ਆਏ ਹੋਏ ਨੇ ਤੁਹਾਡੇ ਰੈਸਟੋਰੈਂਟ ਦੇ ਖਾਣੇ ਦੀ ਬਹੁਤ ਤਾਰੀਫ ਸੁਣੀ ਹੈ ਲੋਕਾਂ ਕੋਲੋਂ ਅਤੇ ਅਸੀਂ ਵੀ ਅਕਸਰ ਇਸ ਰੈਸਟੋਰੈਂਟ ਤੋਂ ਖਾਣਾ ਮੰਗਵਾਉਂਦੇ ਰਹਿੰਦੇ ਹਾਂ ਮੈਂ ਗਲੀ ਨੰਬਰ ਦੋ ਦੀ ਨਿਵਾਸੀ ਹਾਂ ਕੀ ਤੁਸੀਂ ਉਸ ਏਰੀਆ ਦੇ ਵਿੱਚ ਆਪਣੇ ਰੈਸਟੋਰੈਂਟ ਤੋਂ ਡਿਲੀਵਰ ਅ ਖਾਣਾ ਕਰ ਦਿੰਦੇ ਹੋ ਠੀਕ ਹੈ ਸਰ ਮੇਰਾ ਔਡਰ ਨੋਟ ਕਰ ਲਉ ਤਿੰਨ ਪਲੇਟ ਦਾਲ ਮੱਖਣੀ ਨਾਲ ਛੇ ਬਟਰ ਨਾਨ ਦੋ ਪਲੇਟ ਜੀਰਾ ਰਾਈਸ ਨਾਲ ਸ਼ਾਹੀ ਪਨੀਰ ਅਤੇ ਕੜਾਹੀ ਪਨੀਰ ਨਾਲ ਤਿੰਨ ਪਲੇਟ ਰਾਇਤਾ ਵੀ ਕਰ ਦਈਓ ਅਤੇ ਮਿੱਠੇ ਦੇ ਵਿੱਚ ਗਰਮ ਗੁਲਾਬ ਜਾਮੁਨਾਂ ਕਰ ਦਈਓ ਸਰ ਇਹ ਸਾਰਾ ਔਡਰ ਜੋ ਹੈ ਇਹ ਜਲਦ ਤੋਂ ਜਲਦ ਮੇਰੇ ਘਰ ਡਿਲੀਵਰ ਕਰ ਦਈਓ ਅਤੇ ਜੋ ਖਾਣਾ ਹੈ ਉਹ ਘੱਟ ਮਸਾਲੇਦਾਰ ਰੱਖੀਓ ਤੁਸੀਂ ਮੇਰੇ ਘਰ ਦੇ ਕੋਲ ਆ ਕੇ ਮੈਨੂੰ ਮੇਰੇ ਫ਼ੋਨ ਨੰਬਰ 'ਤੇ ਗੱਲ ਕਰ ਸਕਦੇ ਹੋ ਮੇਰੇ ਘਰ ਦਾ ਐਡਰੈੱਸ ਜਾਣਨ ਲਈ ਅਤੇ ਅਲੱਗ ਤੋਂ ਇੱਕ ਬਿੱਲ ਜ਼ਰੂਰ ਭੇਜ ਦਈਓ ਧੰਨਵਾਦ